ਹੈਲੋ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਤੁਸੀਂ ਕੋਣ ਹਾਂਜੀ ਹਾਂਜੀ ਬੇਕਰੀ ਦਾ ਭਾਅ ਜੀ ਇਥੇ ਬਹੁਤ ਆ ਤੁਸੀਂ ਕਿਹੜੀ ਮਤਲਬ ਕੀ ਚੀਜ਼ ਖਾਣਾ ਚਾਹੁੰਦੇ ਹੋ ਪੈਟੀ ਭਾਅ ਜੀ ਇੱਕ ਤਾਂ ਜੀਐਸ ਦੀ ਬਹੁਤ ਸਵਾਲ ਹੁੰਦੀ ਹ ਜੀਐਸ ਬੇਕਸ ਵਰਡ ਹ ਨਾ ਇੱਥੇ ਹੁਸ਼ਿਆਰਪੁਰ ਇੱਕ ਸਰਤਾਜ ਆ ਜੇਐਸ ਬੇਕਰ ਵਾਲੇ ਡੀਏਵੀ ਕਾਲਜ ਕੋਲ ਆ ਭਾਅ ਜੀ ਇਸਲਾਮਾਬਾਦ ਕੋਲ ਰਸਤੇ ਤੇ ਆਂਦਾ ਤੇ ਸਰਤਾਜ ਦੀ ਪੈਟੀ ਬਹੁਤ ਸੁਆਦ ਹੁੰਦੀ ਆ ਇਹਦੀ ਜੇ ਪੈਟੀ ਖਾਣੀ ਤੁਸੀਂ ਚਾਰ ਵਜੇ ਤੋਂ ਤਿੰਨ ਜਾਂ ਚਾਰ ਵਜੇ ਤੋਂ ਪਹਿਲਾਂ ਪਹਿਲਾਂ ਹੀ ਫਰੈਸ਼ ਬਣਾਉਂਦੇ ਇਹਨਾਂ ਦੀ ਬਹੁਤ ਜਲਦੀ ਖਤਮ ਹੋ ਜਾਂਦੀ ਆ ਨਹੀਂ ਹਾਂਜੀ ਸ਼ਾਮ ਨੂੰ ਜੇ ਖਾਣੀ ਹੈ ਤਾ ਡੀਲਕਸ ਵੀ ਹੈਗਾ ਵਾ ਫਰੈਂਚ ਹੈਗਾ ਵਾ ਚੌਧਰੀ ਦੀ ਚੌਧਰੀ ਬੇਕਰੀ ਵੀ ਹੈਗੀ ਪਰ ਉਹਦੀ ਆਲੂ ਪੈਟੀ ਨਾ ਇਨੀ ਪ੍ਰੈਫਰ ਨਹੀਂ ਮੈਂ ਕਰਦਾ ਸਵਾਦ ਨਹੀਂ ਹੁੰਦੀ ਜਿਆਦਾ ਹਾਂਜੀ ਹਾਂਜੀ ਇਹ ਸਰਤਾਜ ਕੋਲ ਤਾਂ ਮਿਲਦੀਆਂ ਚੀਜ਼ ਮਸ਼ਰੂਮ ਔਰ ਆਲੂ ਪੈਟੀ ਇੱਕ ਪੀਜ਼ਾ ਪੀਜ਼ਾ ਪੈਟੀ ਵੀ ਮਿਲਦੀ ਆ ਉਹ ਵੀ ਬਹੁਤ ਵਧੀਆ ਹੁੰਦੀ ਆ ਇਹਦੀ ਪਰ ਚੀਜ਼ ਬਹੁਤ ਸਵਾਲ ਹੁੰਦੀ ਹ ਚੀਜ਼ ਮੈਂ ਤੁਹਾਨੂੰ ਰਿਕਮੈਂਡ ਕਰਦਾ ਆਲੂ ਵੀ ਸਵਾਦ ਦੇ ਦੋ ਬਹੁਤ ਵਧੀਆ ਇਹਨਾਂ ਦੀਆਂ ਜੀ ਐਸ ਟੀ ਵੀ ਸਾਰੀਆਂ ਵਧੀਆ ਹੁੰਦੀਆਂ ਆਲੂ ਚੀਜ਼ ਮਸ਼ਰੂਮ ਪਾਸਾ

ਹਾਂਜੀ ਹਾਂਜੀ ਉਹ ਤਾਂ ਉਹਦਾ ਹੈ ਹੀ ਉਹ ਬਜਟ ਫਰੈਂਡ ਬਿਕਰੀ ਆ ਉਥੇ ਜੇ ਜਾਣਾ ਬੰਦਾ ਘੱਟ ਪੈਸਿਆ ਨਾ ਜਾਵੇ ਵੀਹ ਰੁਪਏ ਤੀਹ ਰੁਪਏ ਇੰਨੇ ਪੈਸੇ ਹੋਣੇ ਚਾਹੀਦੇ ਉਨਾ ਵਧੀਆ ਢਿੱਡ ਭਰ ਸਕਦਾ ਇੱਕ ਬੰਦੇ ਦਾ ਉਹਦੀ ਲੈਮਨ ਨਾਲ ਪੈਟੀ ਬਹੁਤ ਫੇਮਸ ਆ ਇਹ ਹੈਗਾ ਭਾਅ ਜੀ ਇਹ ਕੱਚਾ ਟੋਬਾ ਕੱਚਾ ਟੋਬਾ ਪੈਂਦਾ ਹਾਂਜੀ ਹਾਂਜੀ ਇਹ ਥੋੜੀ ਐਕਸਪੈਂਸਿਵ ਵਾਲੀ ਬੇਕਰੀ ਤੇ ਆ ਜਾਂਦਾ ਨਾ ਭਾਅ ਜੀ ਇਹ ਮਤਲਬ ਇਥੇ ਸੀ ਬੈਠੀ ਜਦੋਂ ਸਰਕਾਰ ਤੇ ਜੇ ਅਸੀਂ ਸਵਾਲ ਹੁੰਦੀ ਆ ਹਾਂਜੀ ਡੀਲਕਸ ਦੀ ਵੀ ਸਵਾਦ ਹੁੰਦੀ ਆ ਡੀਲਕਸ ਬੇਕਰੀ ਦੀ ਆਈਟਮ ਭਾਅ ਜੀ ਇਹ ਤਾ ਹੁਣ ਤੁਹਾਡੇ ਮੂਡ ਤੇ ਤੁਸੀਂ ਬਰਗਰ ਖੈਣਾ ਚਾਹੋਗੇ ਪੀਜਾ ਪਾਸਤਾ ਪੈਟੀ ਕੁਲਚਾ ਬਹੁਤ ਚੀਜ਼ਾਂ ਹਨਾ ਉਨਾਂ ਦੇ ਤਾਂ ਮੈਂ ਤੇ ਜਿਆਦਾ ਬੇਕਰੀ ਜਾਵਾ ਤਾ ਪੀਜ਼ਾ ਉਹ ਹੀ ਪੈਟੀ ਖਾਣਾ ਪ੍ਰੈਫਰ ਕਰੂੰਗਾ ਪੈਟੀ ਜਿਆਦਾ ਵਧੀਆ ਰਹਿੰਦੀ ਹਾਂਜੀ ਤੁਸੀਂ ਦੱਸ ਦੋ ਕੀ ਖਾਣਾ ਚਾਹੁੰਦੇ ਹੋ ਪੈਟੀ ਤੇ ਓਹ ਬੇਕਰੀ ਤੇ ਪੈਟੀ ਉਹਦੀ ਕੀ ਕਹਿੰਦੇ ਆਪਣਾ ਡੀਲਕਸ ਵੀ ਜਾ ਕੇ ਖਾਓ ਓਥੇ ਕੈਪਸੀਕਮ ਪੈਟੀ ਮਿਲਦੀ ਉਹ ਵੀ ਬੜੀ ਯੂਨੀਕ ਪੈਟੀ ਹੈਗਾ ਸੀ ਅਲੱਗ ਟੇਸਟ ਆ ਮਿਊਨਿਸਟ ਪਾਈ ਹੁੰਦੀ ਆ ਉਹ ਕੈਪਸਕਮ ਅਨੀਅਨ ਇਹ ਸਭ ਪਾਏ ਹੁੰਦੇ ਆ ਕਾਫੀ ਯੂਨੀਕ ਪੈਟੀ ਆ ਹਾਂਜੀ ਮੇਨਲੀ ਤਾਂ ਇਹੀ ਹੁੰਦਾ ਇਹਨਾਂ ਦੇ ਟੇਸਟ ਮਿਲਿਆ ਬਾਕੀ ਮਸਾਲੇ ਮਸੂਲੇ ਪਾਏ ਹੁੰਦੇ ਆਪਣੇ ਇਹ ਯੂਨੀਕ ਪੈਟੀ ਆ ਹਾਂਜੀ ਹਾਂਜੀ ਮੀਨਜ ਪਿਆਜ ਟਮਾਟਰ ਇਹੀ ਸਭ ਪਾਂਦੇ ਹਾਂਜੀ ਹਾਂਜੀ ਉਹ ਮੈਨੂੰ ਲੱਗਦਾ ਵੀਹ ਪੱਚੀ ਰੁਪਏ ਦੀ ਹੋਣੀ ਆਲੂ ਪੈਟੀ ਵੀ ਸਵੈਦ ਆ ਚੀਜ਼ ਪੈਟੀ ਵੀ ਸਵਾਦ ਆ ਬਟਰ ਕੁਲਚਾ ਵੀ ਸਵਾਦ ਆਉਣਾ ਤਾਂ ਬਹੁਤ ਜਿਆਦਾ ਹਾਂਜੀ ਹਾਂਜੀ ਕੇਕ ਵਗੈਰਾ ਜੇ ਤੁਹਾਨੂੰ ਕੇਕ ਵਗੈਰਾ ਚਾਹੀਦੇ ਆ ਤਾਂ ਸਰਤਾਜ ਉਹਦਾ ਕੇਕ ਬੈਸਟ ਹੁੰਦੇ ਆ ਪੂਰੇ ਹਾਂਜੀ ਕੇਕ ਉਹਦੇ ਬੈਸਟ ਇਹ ਭਾਅ ਜੀ ਸਟੈਰੀ ਰੋਡ ਤੇ ਆ ਤੁਸੀਂ ਕਿਸੇ ਨੂੰ ਪੁੱਛਿਓ ਸਰਤਾਜ ਬੇਰੀ ਦੱਸ ਦੋ ਉਹ ਥੋਨੂੰ ਆਪ ਲੈ ਕੇ ਜਾਊਗਾ ਬਹੁਤ ਫੇਮਸ ਬੇਕਰੀ ਆ ਹਾਂ ਓਕੇ ਓਕੇ ਭਾਅ ਜੀ